ਮੈਂ ਪੰਜਾਬ ਦਾ ਰਹਿਣ ਵਾਲਾ ਨਿਵਾਸੀ ਹਾਂ ਮੇਰੇ ਮੁਤਾਬਕ ਪੰਜਾਬ ਇੱਕ ਇਹੋ ਜਿਹਾ ਸ਼ਹਿਰ ਹੈ ਜਿਸ ਵਿੱਚ ਖੇਡਾਂ ਪ੍ਰਤੀ ਲੋਕ ਜਾਗਰੂਕ ਵੀ ਹਨ ਪਰ ਖੇਡਾਂ ਖੇਡਣ ਵਾਸਤੇ ਜਗ੍ਹਾ ਨਹੀਂ ਪੰਜਾਬ ਵਿੱਚ ਕਈ ਇਹੋ ਜਿਹੇ ਵੀ ਡਿਸਟਰਿਕ ਜਾਂ ਪਿੰਡ ਹੈ ਜਿਨ੍ਹਾਂ ਵਿੱਚ ਖੇਡਾਂ ਦੇ ਮੈਦਾਨ ਤੱਕ ਵੀ ਨਹੀਂ ਇਸਦਾ ਇਹਨਾਂ ਦਾ ਸਭ ਪ੍ਰਮੁੱਖ ਕਾਰਨ ਸਰਕਾਰਾਂ ਦੀ ਬੇਰੁਜ਼ਗਾਰੀ ਅਤੇ ਬੇਨਕਾਮੀ ਹੀ ਹੈ ਇਹ ਪੰਜਾਬ ਵਿੱਚ ਕਈਆਂ ਸ਼ਹਿਰਾਂ ਦੇ ਲੋਕਾਂ ਕੋਲੋਂ ਇਹਨਾਂ ਦੇ ਖੇਡਣ ਦੇ ਸਮਾਨ ਤੱਕ ਵੀ ਨਹੀਂ ਜੇ ਉਹ ਖੇ ਜਿਨ੍ਹਾਂ ਨੂੰ ਖੇਡਣ ਦਾ ਵੀ ਚਾਅ ਹੋਵੇ ਜੋ ਆਪਣੇ ਦੇਸ਼ ਨੂੰ ਵੀ ਇਸ ਮੁਕਾਮ ਤੱਕ ਲੈ ਕੇ ਜਾ ਸਕਣ ਨਾਂ ਉੱਚਾ ਕਰ ਸਕਣ ਪਰ ਉਹਨਾਂ ਕੋਲ ਖੇਡਣ ਯੋਗ ਸਮਾਨ ਤੱਕ ਵੀ ਨਹੀਂ ਖੇਡਾਂ ਦੇ ਸਮਾਨ ਤੱਕ ਵੀ ਨਾ ਹੋਣ ਕਾਰਨ ਉਹਨਾਂ ਨੂੰ ਕੋਈ ਪ੍ਰੋਤਸੋ ਪ੍ਰੋਤਸਾਹਿਤ ਜਾਗਰੂਕ ਕਰਨ ਵਾਲਾ ਨਹੀਂ ਹੁੰਦਾ ਪੰਜਾਬ ਵਿੱਚ ਸ ਕਈ ਇਹੋ ਜਿਹੇ ਵੀ ਪਿੰਡ ਆ ਜਿਨ੍ਹਾਂ ਨੂੰ ਖੇਡਾਂ ਬਾਰੇ ਜਾਗਰੂਕਤਾ ਕਰਨ ਵਾਸਤੇ ਵੀ ਕੋਈ ਸਕੂਲ ਕੋਲਜ ਨਹੀਂ ਹੈ ਇਸ ਦਾ ਪੂਰਾ ਪੂਰਾ ਜ਼ਿੰਮਾ ਸਰਕਾਰ ਹੇਠ ਹੁੰਦਾ ਹੈ ਪਰ ਫੇਰ ਵੀ ਸਰਕਾਰ ਇਹਨਾਂ ਨੂੰ ਦ ਨਜ਼ਰਅੰਦਾਜ਼ ਕਰਦੀਆਂ ਰਹਿੰਦੀਆਂ ਹਨ